ਮੈਂ ਆਪਣੀ ਡਿਊਟੀ ਦੇ ਦੌਰਾਨ ਸਿੱਖਣ ਲਈ ਚੇਨਈ ਤੋਂ ਵੀਹ ਕਿਲੋਮੀਟਰ ਦੂਰ ਅਬਾੜੇ ਜਿੱਥੇ ਪੂਰੀ ਇੰਡੀਅਨ ਆਰਮੀ ਦੇ ਟੈਂਕ ਬਣਦੇ ਹਨ ਉੱਥੇ ਗਿਆ ਸੀ ਅਤੇ ਉੱਥੇ ਮੈਂ ਜੋ ਜਿਵੇਂ ਕਿ ਕਿਵੇਂ ਟੈਂਕ ਉਹ ਤਰਤੀਬ ਬਣਾਉਂਦੇ ਹਨ ਉਹਦੇ ਵਿੱਚ ਹਰੇਕ ਕਿਸਮ ਦਾ ਜਿਵੇਂ ਮਿਜ਼ਾਇਲਾਂ ਦਾ ਸਿਸਟਮ ਕੀ ਕਰਦੇ ਹਨ ਅਤੇ ਗੌਲ਼ਿਆਂ ਦਾ ਬਰੂਦ ਦਾ ਕਿਵੇਂ ਤਿਆਰ ਹੁੰਦਾ ਹੈ ਉਹਦੇ ਸਿੱਖਣ ਲਈ ਮੈਂ ਉੱਥੇ ਦੋ ਤਿੰਨ ਮਹੀਨੇ ਲਗਾਤਾਰ ਰਿਹਾ ਅਤੇ ਉੱਥੋਂ ਸਿੱਖਣ ਲਈ ਮੈਂ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੀ ਉਹ ਕੌਂਪਲੈਕਸ ਜਿਹਨੂੰ ਕਹਿੰਦੇ ਹਨ ਉਹਦੇ ਵਿੱਚ ਜਾਂਦਾ ਸੀ ਅਤੇ ਉੱਥੇ ਪੂਰੀ ਟੈਂਕ ਬਾਰੇ ਜਾਣਕਾਰੀ ਹਾਸਿਲ ਕਰਦਾ ਸੀ ਅਤੇ ਉੱਥੋਂ ਸਿੱਖਣ ਤੋਂ ਬਾਅਦ ਮੈਂ ਪੂਰੇ ਆਪਣੇ ਕੰਮ ਵਿੱਚ ਮਾਹਿਰ ਹੋਇਆ